ਮੈਨੂੰ ਟੂਰ 'ਤੇ ਜਾਣ ਦਾ ਬਹੁਤ ਸ਼ੌਕ ਹੈ ਮੈਂ ਕਈ ਵਾਰ ਪਹਾੜਾਂ ਅਤੇ ਰੇਗਿਸਤਾਨ ਦੀ ਸੈਰ ਕਰ ਚੁੱਕਿਆ ਹਾਂ ਟੂਰ 'ਤੇ ਜਾਣ ਲਈ ਕੁਝ ਖਾਸ ਗੱਲਾਂ ਦਾ ਧਿਆਨ ਰੱਖਣਾ ਪੈਂਦਾ ਹੈ ਜੇਕਰ ਤੁਸੀਂ ਮੋਟਰਸਾਇਕਲ 'ਤੇ ਪਹਾੜਾਂ ਵਿੱਚ ਜਾ ਰਹੇ ਹੋ ਤਾਂ ਉਸ ਦੇ ਲਈ ਹੈਲਮਟ ਅਤੇ ਚੰਗੇ ਬੂਟ ਨਾਲ ਜ਼ਰੂਰੀ ਹਨ ਇਸ ਤੋਂ ਇਲਾਵਾ ਠੰਡ ਤੋਂ ਬਚਣ ਦੇ ਲਈ ਵਿੰਡਸ਼ੀਟਰ ਅਤੇ ਵਿੰਡਸ਼ੀਟਰ ਦੇ ਵਰਗੀਆਂ ਹੀ ਲੋਅਰਾਂ ਜ਼ਰੂਰੀ ਹੰਦੀਆਂ ਹਨ ਜੇਕਰ ਤੁਸੀਂ ਬੱਸ ਵਿੱਚ ਸਫਰ ਕਰ ਰਹੇ ਹੋ ਤਾਂ ਪਾਣੀ ਦੀ ਬੋਤਲ ਅਤੇ ਕੁਝ ਨਾ ਕੁਝ ਖਾਣ ਲਈ ਤੁਹਾਡੇ ਕੋਲ ਹੋਣਾ ਬਹੁਤ ਜ਼ਰੂਰੀ ਹੈ ਇਸ ਤੋਂ ਇਲਾਵਾ ਜਿੱਥੇ ਵੀ ਤੁਸੀਂ ਟੂਰ 'ਤੇ ਜਾ ਰਹੇ ਹੋ ਉੱਥੇ ਰਾਤ ਕਿੱਥੇ ਬਿਤਾਉਣੀ ਹੈ ਉਸ ਦੇ ਲਈ ਹੋਟਲ ਦੀ ਬੁਕਿੰਗ ਪਹਿਲਾਂ ਕਰਵਾਉਣੀ ਜ਼ਰੂਰੀ ਹੁੰਦੀ ਹੈ ਜੇਕਰ ਅਸੀਂ ਇਹਨਾਂ ਸਾਰੀਆਂ ਗੱਲਾਂ ਦਾ ਧਿਆਨ ਰੱਖਦੇ ਹਾਂ ਤਾਂ ਅਸੀਂ ਟੂਰ ਨੂੰ ਬਹੁਤ ਵਧੀਆ ਬਣਾ ਸਕਦੇ ਹਾਂ